ਭਾਰਤੀ ਆਵਾਜਾਈ ਪ੍ਰਣਾਲੀ ਅੱਜ ਇੱਕ ਵਿਕਸਿਤ ਆਵਾਜਾਈ ਪ੍ਰਣਾਲੀ ਦੇ ਤੌਰ 'ਤੇ ਜਾਣੀ ਜਾ ਰਹੀ ਹੈ ਸੜਕਾਂ ਨੂੰ ਬਰੋਡ ਕੀਤਾ ਜਾ ਰਿਹਾ ਹੈ ਛੇ ਤੋਂ ਅੱਠ ਲੇਨ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਭੀੜ ਨਾ ਰਹੇ ਲੋਕਾਂ ਨੂੰ ਆਉਣ ਜਾਣ ਵਿੱਚ ਦਿੱਕਤ ਨਾ ਹੋਵੇ ਜਿਵੇਂ ਪਹਿਲਾਂ ਲੋਕ ਲਾਈਨਾਂ ਦੇ ਵਿੱਚ ਲੱਗੇ ਰਹਿੰਦੇ ਸਨ ਜਦੋਂ ਵੀ ਫਾਟਕ ਬੰਦ ਹੋ ਜਾਂਦਾ ਸੀ ਅੱਜ ਉੱਥੇ ਫਲਾਈਓਵਰ ਬਣ ਚੁੱਕੇ ਹਨ ਤਾਂ ਜੋ ਉਹਨਾਂ ਨੂੰ ਆਉਣ ਜਾਣ ਵਿੱਚ ਕੋਈ ਦੁਵਿਧਾ ਨਾ ਹੋਵੇ ਪਰ ਇੱਕ ਦਿੱਕਤ ਅਜੇ ਵੀ ਹੈ ਉਹ ਹੈ ਟੋਲ ਟੈਕਸ ਸਰਕਾਰਾਂ ਨੂੰ ਚਾਹੀਦਾ ਹੈ ਕਿ ਫਰੀ ਟੋਲ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਇਹ ਵੀ ਦਿੱਕਤ ਨਾ ਹੋਵੇ ਇਸ ਤੋਂ ਬਾਅਦ ਅਗਰ ਦੇਖੀਏ ਤਾਂ ਟਰੇਨਸ ਨਵੀਆਂ ਨਵੀਆਂ ਚਲਾਈਆਂ ਜਾ ਰਹੀਆਂ ਹਨ ਐਡਵਾਂਸ ਟੈਕਨੋਲੋਜੀ ਵਾਲੀਆਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਵਿੱਚ ਕਾਫ਼ੀ ਅੱਛਾ ਭੋਜਨ ਵਗੈਰਾ ਮਿਲਦਾ ਹੈ ਫੂਡ ਸਰਵਿਸ ਬਹੁਤ ਹੀ ਅੱਛੀ ਹੈ ਟਾਈਮ ਟੂ ਟਾਈਮ ਪਹੁੰਚਾਉਂਦੀਆਂ ਹਨ ਪਹਿਲਾਂ ਦੀ ਤਰ੍ਹਾਂ ਨਹੀਂ ਕਿ ਲੇਟ ਕਰ ਦਿੱਤੀਆਂ ਟਾਈਮ ਕੁਛ ਹੋਰ ਅਤੇ ਪਹੁੰਚਾ ਕੁਛ ਹੋਰ ਪਹੁੰਚਾ ਕਿਸੇ ਹੋਰ ਟਾਈਮ 'ਤੇ ਰਹੀਆਂ ਹਨ ਵੋਲਵੋ ਬੱਸਿਜ਼ 'ਚ ਵੀ ਅਵੇਲੇਬਿਲਿਟੀ ਹੋ ਗਈ ਹੈ ਲੋਂਗ ਰੂਟ ਵਾਸਤੇ ਬਹੁਤ ਹੀ ਕੰਫਰਟੇਬਲ ਬੱਸਿਜ਼ ਨੇ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਹੁੰਦੀਆਂ ਨੇ ਮੈਟਰੋਪੋਲੀਟਨ ਸਿਟੀ ਦੇ ਵਿੱਚ ਮੈਟਰੋਜ ਲਗਾਈਆਂ ਗਈਆਂ ਹਨ ਔਰ ਅੰਮ੍ਰਿਤਸਰ ਵਿੱਚ ਵੀ ਮੈਟਰੋ ਵਾਲਾ ਪ੍ਰੋਜੈਕਟ ਬਹੁਤ ਜਲਦ ਆ ਰਿਹਾ ਹੈ ਅਗਰ ਲੋਕਲ ਦੀ ਗੱਲ ਕਰੀਏ ਤਾਂ ਔਟੋਜ ਐਂਡ ਈ ਰਿਕਸ਼ਾਸ ਦੇ ਕਾਰਨ ਆਮ ਸਵਾਰੀਆਂ ਨੂੰ ਬਹੁਤ ਹੀ ਸੁਵਿਧਾ ਹੁੰਦੀ ਆ ਜਿੱਥੇ ਔਟੋ ਪੋਲਿਊਸ਼ਨ ਕਰਦੇ ਸੀ ਈ ਰਿਕਸ਼ਾ ਅੱਜ ਪੋਲਿਊਸ਼ਨ ਫਰੀ ਇਨਵਾਇਰਮੈਂਟ ਵੀ ਸਾਨੂੰ ਪ੍ਰਦਾਨ ਕਰ ਰਹੇ ਹਨ ਧੰਨਵਾਦ